ਹੈਲੋ ਕੀ ਹਾਲ ਆ ਅੰਮ੍ਰਿਤ ਵਧੀਆ

ਬਸ ਕੁਛ ਨਹੀਂ ਵੇਹਲੇ ਹਾਂ ਹਾਂ ਚੱਲ ਰਹੇ ਨੇ ਸਾਡੇ ਪਿੰਡ ਕੱਲ੍ਹ ਨੂੰ ਉਹ ਨਗਰ ਕੀ ਨਗਰ ਕੀਰਤਨ ਆਉਣਾ ਸੀ ਹਾਂ ਅੱਛਾ ਹਾਂ ਹਾਂ ਹਾਂ ਹਾਂ ਕੱਲ੍ਹ ਨੂੰ ਨਗਰ ਕੀਰਤਨ ਜਾਣਾ ਉੱਥੇ ਮਿਲ ਲਾਂਗੇ ਤੈਨੂੰ ਹਾਂ ਉੱਥੇ ਸੇਵਾ ਕਰ ਲਾਂਗੇ

ਹਾਂ ਹਾਂ ਹਾਂ ਹਾਂ ਹਾਂ ਫਿਰ ਧਰਤੀ ਵੀ ਫਿਰ ਧਰਤੀ ਵੀ ਤਾਂ ਉਹ ਹਾਂ ਫਿਰ ਫਤਿਹਗੜ੍ਹ ਸਾਹਿਬ ਦੀ ਧਰਤੀ ਵੀ ਤਾਂ ਸਾਰਿਆਂ ਨਾਲੋਂ ਮਹਿੰਗੀ ਆ ਹਾਂ ਹਾਂ ਹਾਂ ਕੋਈ ਗੱਲ ਨਹੀਂ ਸੇਵਾ ਕਰ ਲਿਆ ਕਰਾਂਗੇ ਠੀਕ ਆ ਠੀਕ ਆ ਠੀਕ ਆ ਇੱਕ ਤਾਂ ਮੈਂ ਕੱਲ੍ਹ ਕੱਲ ਨੂੰ ਵੀ ਆਉਂਗਾ ਠੀਕ ਆ ਕੱਲ੍ਹ ਨੂੰ ਨਗਰ ਕੀਰਤਨ ਜਾਣਾ ਸੀ ਨਾ ਤਾਂ ਕਰਕੇ ਹਾਂ ਅੱਛਾ ਠੀਕ ਹੈ ਠੀਕ ਹੈ ਹਾਂ ਹੋਰ ਚੱਲ ਠੀਕ ਆ ਫਿਰ ਠੀਕ ਹੈ